ਸਾਡੇ ਮੋਹਾਲੀ ਜ਼ਿਲ੍ਹੇ ਦੇ ਕਰਾਲੀ ਸ਼ਹਿਰ ਵਿੱਚ ਇੱਕ ਗਸਾਈਆਂ ਵਾਲਾ ਡੇਰਾ ਬਾਬਾ ਦੇ ਬਹੁਤ ਵਧੀਆ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ ਜੋ ਆਏ ਸਾਲ ਕਰਾਇਆ ਜਾਂਦਾ ਹੈ ਇੱਥੇ ਰੰਗਾ ਰੰਗ ਪ੍ਰੋਗਰਾਮ ਤੋਂ ਇਲਾਵਾ ਖੇਡਾਂ ਕਬੱਡੀ ਜਿਵੇਂ ਕਿ ਛਿੰਝ ਮੇਲਾ ਵੀ ਕਰਾਇਆ ਜਾਂਦਾ ਹੈ ਇੱਥੇ ਬਹੁਤ ਦੂਰ ਦੂਰੋਂ ਡੇਰਾ ਸ ਵਿੱਚ ਆਪਣੀਆਂ ਸ਼ੁਭਕਾਮਨਾਵਾਂ ਲੈ ਕੇ ਆਉਂਦੇ ਹਨ ਅਤੇ ਆਪਣੇ ਆਪ ਮੱਥਾ ਟੇਕਦੇ ਹਨ ਉੱਥੇ ਅਤੇ ਇੱਥੋਂ ਆਪਣੇ ਘਰ ਪ੍ਰਤੀ ਖੁਸ਼ੀਆਂ ਪ੍ਰਾਪਤ ਕਰਦੇ ਹਨ ਇਹ ਡੇਰਾ ਬਹੁਤ ਪ੍ਰਾਚੀਨ ਹੈ ਇਸ ਦੇ ਲਾਗ ਰੇਲਵੇ ਲਾਈਨ ਦੇ ਨਜ਼ਦੀਕ ਪੈਂਦਾ ਹੈ ਕਰਾਲੀ ਸ਼ਹਿਰ ਵਿੱਚ ਪੈਂਦਾ ਹੈ